ਬੱਸ ਅੱਡੇ ਛੋਟੇ ਹੋਣ ਕਾਰਨ ਜੋ ਸਵਾਰੀਆਂ ਹਨ ਉਹ ਅੱਡਿਆਂ ਤੋਂ ਬਾਹਰ ਰੋਡ 'ਤੇ ਹੀ ਖੜ੍ਹ ਜਾਂਦੀਆਂ ਹਨ ਅਤੇ ਕੁਛ ਕੁ ਜੋ ਅੰਦਰ ਬੈਠੀਆਂ ਰਹਿੰਦੀਆਂ ਹਨ ਅਤੇ ਅੱਡੇ ਛੋਟੇ ਹੋਣ ਕਾਰਨ ਭੀੜ ਬਹੁਤ ਵੱਧ ਜਾਂਦੀ ਹੈ ਅਤੇ ਆਉਣ ਜਾਣ ਦੇ ਜੋ ਆਮ ਯਾਤਰੀ ਹੁੰਦੇ ਹਨ ਉਹ ਵੀ ਬਹੁਤ ਪ੍ਰੇਸ਼ਾਨ ਹੁੰਦੇ ਹਨ ਅਤੇ ਬੱਸਾਂ ਵਿੱਚ ਭੀੜ ਵੀ ਬਹੁਤ ਹੁੰਦੀ ਹੈ ਅਸੀਂ ਇਹਨਾਂ ਨੂੰ ਇੱਦਾਂ ਠੀਕ ਕਰ ਸਕਦੇ ਹਾਂ ਕਿ ਜਿਵੇਂ ਕਿ ਮੰਨ ਲਉ ਇੱਕ ਰੂਟ 'ਤੇ ਜਾਣ ਵਾਲੇ ਕਾਫ਼ੀ ਯਾਤਰੀ ਹਨ ਤਾਂ ਉਸ ਰੂਟ 'ਤੇ ਬੱਸਾਂ ਦੀ ਗਿਣਤੀ ਵਧਾਈ ਜਾਵੇ ਟਰੇਨਾਂ ਦੀ ਗਿਣਤੀ ਵਧਾਈ ਜਾਵੇ ਠੀਕ ਹੈ ਅਤੇ ਦੂਜੀ ਗੱਲ ਬੱਸ ਅੱਡਿਆਂ ਨੂੰ ਥੋੜ੍ਹਾ ਵਧੀਆ ਤਰੀਕੇ ਨਾਲ਼ ਬਣਾਇਆ ਜਾਵੇ ਅਤੇ ਉੱਥੇ ਕੁਰਸੀਆਂ ਜਾਂ ਟੇਬਲ ਲਗਾਏ ਜਾਣ ਜਿਹਦੇ 'ਤੇ ਆਮ ਨਾਗਰਿਕ ਬੈਠ ਸਕਣ ਜੋ ਬੱਸ ਦੀ ਵੇਟ ਕਰ ਰਹੇ ਹਨ ਤੋ ਜਿਸ ਕਾਰਨ ਵੀ ਭੀੜ ਘੱਟ ਰਹੂਗੀ ਅਤੇ ਅੱਡੇ 'ਤੇ ਇੱਕ ਗਾਈਡ ਮੈਨ ਵੀ ਹੋਣਾ ਚਾਹੀਦਾ ਜੋ ਦੱਸੇ ਵੀ ਤੁਸੀਂ ਉਰੇ ਖੜ੍ਹੋ ਤੁਹਾਨੂੰ ਉਰੇ ਤੋਂ ਬੱਸ ਮਿਲੂਗੀ ਕਈ ਆਮ ਨਾਗਰਿਕ ਗਲਤ ਬੱਸ 'ਚ ਬੈਠ ਜਾਂਦੇ ਹਨ ਅਤੇ ਬਹੁਤ ਪ੍ਰੇਸ਼ਾਨ ਹੁੰਦੇ ਹਨ ਅਤੇ ਬੱਸਾਂ ਵੀ ਬਹੁਤ ਜੋ ਟਾਇਮ 'ਤੇ ਨਹੀ ਆਉਂਦੀਆਂ ਹਨ ਕਿਉਂਕਿ ਬੱਸਾਂ ਟਾਇਮ 'ਤੇ ਤਾਂ ਨਹੀ ਆਉਂਦੀਆਂ ਰਸਤੇ ਵਿੱਚ ਟ੍ਰੈਫਿਕ ਬਹੁਤ ਹੁੰਦੀ ਹੈ ਤਾਂ ਹਰੇਕ ਮੋੜ 'ਤੇ ਇੱਕ ਟ੍ਰੈਫਿਕ ਪੁਲਿਸ ਵਾਲਾ ਚਾਹੀਦਾ ਹੈ ਜੋ ਕਿ ਟ੍ਰੈਫਿਕ ਨੂੰ ਦੇਖਦਾ ਰਹੇ ਅੋਰ ਜਾਮ ਨੂੰ ਖੁਲਾਉਂਦਾ ਰਹੇ ਆਮ ਤੌਰ 'ਤੇ ਤੁਸੀਂ ਦੇਖਿਆ ਹੀ ਹੋਊਗਾ ਕਿ ਜੋ ਮੈਨ ਰੋਡ ਹੁੰਦਾ ਹੈ ਜ ਜਿੱਥੋਂ ਕਾਫੀ ਜ਼ਿਆਦਾ ਆਵਾਜਾਈ ਹੁੰਦੀ ਹੈ ਤਾਂ ਉੱਥੇ ਜਾਮ ਲੱਗਿਆ ਹੀ ਰਹਿੰਦਾ ਹੈ ਅਤੇ ਉੱਥੇ ਦੋ ਚਾਰ ਪੁਲਿਸ ਮੁਲਾਜ਼ਮਾਂ ਦਾ ਹੋਣਾ ਜ਼ਰੂਰੀ ਹੈ ਜੋ ਕਿ ਜਾਮ ਨੂੰ ਖੋਲ੍ਹ ਸਕਣ ਅੋਰ ਜੋ ਯਾਤਰੀ ਹੈ ਉਹਨਾਂ ਨੂੰ ਟਾਇਮ ਸਿਰ ਬੱਸਾਂ ਪਹੁੰਚਾ ਦੇਵੇ